ਬਹੱਤਰ ਚਾਰ ਸੌ ਛਿਆਸੀ ਪੰਜ ਹਜ਼ਾਰ ਛੇ ਸੌ ਸੱਤਰ ਉੱਨੀ ਹਜ਼ਾਰ ਸੱਤ ਸੌ ਬਿਆਲੀ ਸੱਤ ਲੱਖ ਬਿਆਲੀ ਹਜ਼ਾਰ ਅੱਠ ਸੌ ਚਾਲ੍ਹੀ